ਪੰਜਾਬੀ ਭਾਸ਼ਾ ਨੇ ਸੱਭਿਆਚਾਰ ਨੂੰ ਕਾਫ਼ੀ ਮੇਰੇ ਪੰਜਾਬ ਦੇ ਸੱਭਿਆਚਾਰ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਕਿਉਂਕਿ ਜੇ ਮੈਂ ਕਿਸੇ ਦੇ ਨਾਲ ਬੋਲਚਾਲ ਜਦੋਂ ਕਰਦੀ ਹਾਂ ਅਤੇ ਜੇ ਮੈਂ ਉਸ ਬੋਲਚਾਲ ਦੇ ਵਿੱਚ ਕੋਈ ਹਿੰਦੀ ਜਾਂ ਕਿਸੇ ਹੋਰ ਭਾਸ਼ਾ ਦੇ ਦਾ ਵੀ ਇਸਤੇਮਾਲ ਕਰਦੀ ਹਾਂ ਤਾਂ ਦੂਸਰੇ ਬੰਦੇ ਨੂੰ ਦੇਖ ਕੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਮੈਂ ਪੰਜਾਬ ਦੇ ਵਿੱਚ ਹੀ ਰਹਿਣ ਵਾਲੀ ਹਾਂ ਕਿਉਂਕਿ ਮੇਰੇ ਦੂਸਰੇ ਬੰਦੇ ਨਾਲ ਗੱਲਬਾਤ ਕਰਕੇ ਹੀ ਉਸ ਨੂੰ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਪੰਜਾਬਣ ਹੈ ਅਤੇ ਮੇਰੀ ਬੋਲਚਾਲ ਤੋਂ ਹੀ ਸਭ ਜਿਹੜਾ ਹੈ ਅੰਦਾਜ਼ਾ ਲਗਾ ਲੈਂਦੇ ਹਨ ਫਿਰ ਮੇਰਾ ਪਹਿਰਾਵਾ ਵੀ ਕੁਝ ਇੱਦਾਂ ਦਾ ਹੈ ਕਿ ਦੂਰੋਂ ਹੀ ਬੰਦਾ ਪਹਿਛਾਣ ਲੈਂਦਾ ਹੈ ਕਿ ਇਹ ਪੰਜਾਬਣ ਕੁੜੀ ਹੈ ਫਿਰ ਸਾਡੇ ਹੋਰ ਸੱਭਿਆਚਾਰ ਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਬਾਹਰ ਰੈਸਟੋਰੈਂਟ ਵਿੱਚ ਜਾਂਦੀ ਹਾਂ ਤਾਂ ਜ਼ਿਆਦਾਤਰ ਮੈਂ ਸਾਗ ਅਤੇ ਮੱਕੀ ਦੀ ਰੋਟੀ ਨਾਲ ਲੱਸੀ ਦਾ ਗਲਾਸ ਪੀਣ ਦੀ ਕਾਫ਼ੀ ਸ਼ੌਕੀਨ ਹਾਂ ਜਿਸ ਤੋਂ ਕਿ ਲੋਕਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਮੈਂ ਆਪਣੀ ਪੰਜਾਬ ਵਿਰਸੇ ਤੋਂ ਹੀ ਬਿਲੋਂਗ ਕਰਦੀ ਹਾਂ